ਹਾਂਜੀ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ 'ਤੇ ਹੀ ਅੱਜ ਕੱਲ੍ਹ ਸਭ ਤੋਂ ਤੇਜ਼ ਅਪਡੇਟ ਮਿਲਦੀ ਹੈ ਮਿੰਟਾਂ ਸੈਕਿੰਟਾਂ ਵਿੱਚ ਹੀ ਇੱਕ ਖਬਰ ਪੂਰੇ ਦੇਸ਼ ਵਿੱਚ ਘੁੰਮ ਜਾਂਦੀ ਹੈ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਦੇ ਜ਼ਰੀਏ ਫੇਸਬੁੱਕ ਇੰਸਟਾਗ੍ਰਾਮ ਜਾਂ ਟਵਿੱਟਰ ਇੱਕ ਬਹੁਤ ਹੀ ਵਧੀਆ ਮਾਧਿਅਮ ਹੈ ਪਰ ਅੱਜ ਕੱਲ੍ਹ ਇਸ ਦਾ ਕੁਝ ਗਲਤ ਇਸਤੇਮਾਲ ਵੀ ਕਰ ਰਹੇ ਹਨ ਕੁਝ ਲੋਕ ਜੋ ਦੇਖ ਜੋ ਦੇਖ ਕੇ ਬੁਰਾ ਵੀ ਲੱਗਦਾ ਹੈ ਪਰ ਜੇ ਸੋਚਿਆ ਜਾਵੇ ਤਾਂ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਉਦਾਂ ਹੀ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਇਹਨਾਂ ਦੇ ਵੀ ਚੱਲੋ ਹੁੰਦੇ ਨੇ ਹਰੇਕ ਚੀਜ਼ ਦੇ ਹੁੰਦੇ ਨੇ ਦੋ ਪਹਿਲੂ ਹਾਂਜੀ ਸਾਡੇ ਪਰਿਵਾਰ ਵਿੱਚ ਖਬਰਾਂ ਦਾ ਅਪਡੇਟ ਪ੍ਰਾਪਤ ਕਰਨ ਲਈ ਸਾਰੇ ਹੀ ਪਰਿਵਾਰ ਦੇ ਮੈਂਬਰ ਫੇਸਬੁੱਕ ਇੰਸਟਾਗ੍ਰਾਮ ਇਹਦਾ ਇਸਤੇਮਾਲ ਕਰਦੇ ਹੀ ਨੇ ਅੱਜ ਕੱਲ੍ਹ ਤਾਂ ਹਰੇਕ ਏ ਕਰਦਾ ਵੈਸੇ ਪੂਰੇ ਦੇਸ਼ ਦੇ ਵਿੱਚ ਕੋਈ ਹੋਊਗਾ ਜਿਹੜਾ ਨਹੀਂ ਕਰਦਾ ਹੋਣਾ ਅਤੇ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਇਹ ਬਹੁਤ ਵਧੀਆ ਭਰੋਸੇਮੰਦ ਸਰੋਤ ਹੈਗੇ ਨੇ ਅਤੇ ਕੁਝ ਚੀਜ਼ਾਂ ਹੁੰਦੀਆਂ ਹੀ ਨੇ ਚੱਲੋ ਨਹੀਂ ਦੇਖਣ ਵਾਲੀਆਂ ਪਰ ਜ਼ਿਆਦਾਤਰ ਵਧੀਆ ਅਪਡੇਟਸ ਖਬਰਾਂ ਛੇਤੀ ਤੋਂ ਛੇਤੀ ਮਿਲ ਜਾਂਦੀਆਂ ਨੇ ਪਤਾ ਲੱਗ ਜਾਂਦਾ ਸਵੇਰੇ ਉੱਠਦੇ ਹੀ ਪਤਾ ਲੱਗ ਜਾਂਦਾ ਫੋਨ ਚੱਕ ਦੀ ਸਾਰ ਜਦੋਂ ਖੋਲਦੇ ਹਾਂ ਜਦ ਹੀ ਪਤਾ ਲੱਗ ਜਾਂਦਾ ਕੀ ਹੋ ਗਿਆ ਕੀ ਨਹੀਂ ਸਾਰਾ ਕੁਛ